ਹੈਲੋ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਮੈਂ ਤੁਹਾਨੂੰ ਆਪਣੇ ਹੋਸਪੀਟਲ ਬਾਰੇ ਤਸਦੀਰ ਦੱਸਣਾ ਚਾਹੁੰਦੀ ਹਾਂ ਤਾਂ ਕਿ ਜਿਹੜੇ ਸਾਡੇ ਹੋਸਪੀਟਲ ਸਰਕਾਰੀ ਪ੍ਰਾਈਵੇਟ ਸਰਕਾਰੀ ਹੋਸਪੀਟਲਾਂ 'ਤੇ ਬਹੁਤ ਹੀ ਮਾੜਾ ਹਾਲ ਸੀ ਪਹਿਲਾਂ ਹੁਣ ਤਾਂ ਕੁਛ ਥੋੜ੍ਹਾ ਸੰਭਾਲ ਕੇ ਕੀਤੀ ਹੋਈ ਹੈ ਉਹਨਾਂ ਨੇ ਹੁਣ ਤਾਂ ਸਰਕਾਰ ਨੇ ਬਹੁਤ ਹੀ ਵਧੀਆ ਹੋਸਪਿਟਲ ਬਣਾਏ ਹੋਏ ਪਹਿਲਾਂ ਤਾਂ ਖਿੜਕੀਆਂ ਬਾਰੀਆਂ ਟੁੱਟੀਆਂ ਹੋਈਆਂ ਸਨ ਕੁਛ ਵੀ ਵਧੀਆ ਨਹੀਂ ਸੀ ਹਾਲ ਬਿਲਕੁਲ ਟੁੱਟਿਆ ਹੋਇਆ ਸੀ ਕੁਛ ਵੀ ਵਧੀਆ ਨਹੀਂ ਸੀ ਲੱਗਦਾ ਮਰੀਜ਼ ਜਦੋਂ ਜਾਂਦੇ ਸਨ ਉੱਥੇ ਕੁਛ ਵੀ ਉਹਨਾਂ ਨੂੰ ਨਹੀਂ ਸੀ ਨਹੀਂ ਸੀ ਵਧੀਆ ਲੱਗਦਾ ਪ੍ਰਾਈਵੇਟ ਹੋਸਪੀਟਲਾਂ ਵਿੱਚ ਤਾਂ ਖਰਚਾ ਬਹੁਤ ਹੈ ਕੁਛ ਮਰੀਜ਼ ਜਿਹੜੇ ਉਹ ਖਰਚਾ ਨਹੀਂ ਕਰ ਪਾਉਂਦੇ ਇਸ ਕਰਕੇ ਜਿਹੜੇ ਗਰੀਬ ਲੋਕ ਹਨ ਉਹ ਸਰਕਾਰੀ ਹੋਸਪੀਟਲਾਂ ਵਿੱਚ ਜਾਂਦੇ ਜਾਣਾ ਪਸੰਦ ਕਰਦੇ ਹਨ ਉੱਥੇ ਹਰ ਦਸ ਰੁਪਏ ਦੀ ਪਰਚੀ ਕਟ ਹੁੰਦੀ ਹੈ ਅਤੇ ਦਸ ਰੁਪਏ ਵਿੱਚ ਹੀ ਦਵਾਈ ਵੀ ਆ ਜਾਂਦੀ ਹੈ ਅਤੇ ਦਵਾਈ ਥੋੜ੍ਹੀ ਥੋੜ੍ਹੇ ਪੈਸਿਆਂ ਵਿੱਚ ਦਵਾਈ ਦਾ ਹੱਲ ਵੀ ਹੋ ਜਾਂਦਾ ਹੈ ਹੁਣ ਤਾਂ ਕਾਫ਼ੀ ਮਸ਼ੀਨਾਂ ਦਾ ਵੀ ਇੱਥੇ ਪ੍ਰਬੰਧ ਕੀਤਾ ਹੈ ਜਿਹੜੇ ਸਕੈਨ ਵਗੈਰਾ ਸਾਰਾ ਕੁਛ ਅੰਦਰ ਹੀ ਹੋ ਜਾਂਦਾ ਹੈ ਮਰੀਜ਼ਾਂ ਨੂੰ ਬਹੁਤ ਵਧੀਆ ਲੱਗਦਾ ਹੈ ਥੋੜ੍ਹੇ ਪੈਸਿਆ ਵਿੱਚ ਹੀ ਸਾਰਾ ਕੰਮ ਹੋ ਜਾਂਦਾ ਹੈ ਇਸ ਕਰਕੇ ਮਰੀਜ਼ ਉੱਥੇ ਜਾਣਾ ਪਸੰਦ ਕਰਦੇ ਉੱਥੇ ਬਾਥਰੂਮ ਵੀ ਬਹੁਤ ਵਧੀਆ ਸੀ ਪਹਿਲਾਂ ਤਾਂ ਬਹੁਤ ਗੰਦੇ ਹੁੰਦੇ ਸਨ ਹੁਣ ਤਾਂ ਬਹੁਤ ਹੀ ਵਧੀਆ ਅਰੇਜਮੈਂਟ ਕੀਤਾ ਹੈ ਉਹਨਾਂ ਨੇ ਸਾਰਾ ਕੁਝ ਵਧੀਆ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੈ ਜੋ ਕਿ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ ਬਾਥਰੂਮ ਵੀ ਬਹੁਤ ਗੰਦੇ ਹੁੰਦੇ ਸਨ ਹੁਣ ਤਾਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਮਸ਼ੀਨਾਂ ਵੀ ਆ ਚੁੱਕੀਆਂ ਹਨ ਹੁਣ ਸਭ ਕੁਛ ਵਧੀਆ ਹੋਇਆ ਹੈ ਉੱਥੇ ਸਭ ਟੈਸਟ ਟੁਸਟ ਅੰਦਰ ਹੀ ਹੁੰਦੇ ਹਨ ਸਭ ਕੁਛ ਵਧੀਆ ਹੁੰਦਾ ਹੈ